ਸਾਡੇ ਦੇਸ਼ ਵਿੱਚ ਕਈ ਇਹੋ ਜਿਹੇ ਖਿਡਾਰੀ ਹਨ ਜਿਨ੍ਹਾਂ ਨੇ ਕਿ ਆਪਣੇ ਖੇਡ ਨੂੰ ਹੀ ਆਪਣਾ ਕੈਰੀਅਰ ਸਮਝਿਆ ਹੈ ਗੱਲ ਕਰੀਏ ਆਪਾਂ ਪਹਿਲਾਂ ਮਿਲਖਾ ਸਿੰਘ ਦੀ ਮਿਲਖਾ ਸਿੰਘ ਇੱਕ ਬਹੁਤ ਹੀ ਚੰਗਾ ਦੌੜਾਕ ਸੀ ਜਿਸਨੇ ਆਪਣੀ ਖੇਡ ਨੂੰ ਹੀ ਆਪਣਾ ਕੈਰੀਅਰ ਸਮਝਿਆ ਅਤੇ ਬਹੁਤ ਬੁਲੰਦੀਆਂ 'ਤੇ ਗਿਆ ਇਸ ਤੋਂ ਬਾਅਦ ਅਸੀਂ ਜੇ ਗੱਲ ਕਰੀਏ ਵਿਰਾਟ ਕੋਹਲੀ ਐੱਮ ਐੱਸ ਧੋਨੀ ਕਪਿਲ ਦੇਵ ਸੌਰਵ ਗਾਂਗੂਲੀ ਆਦਿ ਇਹ ਸਾਰੇ ਕ੍ਰਿਕਟਰ ਖਿਡਾਰੀ ਹਨ ਇਹਨਾਂ ਨੇ ਵੀ ਆਪਣੇ ਜੀਵਨ ਵਿੱਚ ਆਪਣੀ ਖੇਡ ਨੂੰ ਅਪਣਾ ਕੇ ਆਪਣਾ ਕੈਰੀਅਰ ਬਣਾਇਆ ਹੈ ਇਸ ਤੋਂ ਬਾਅਦ ਜੇਕਰ ਅਸੀਂ ਗੱਲ ਕਰੀਏ ਸਾਨੀਆ ਮਿਰਜ਼ਾ ਮੈਰੀ ਕੌਮ ਸਾਣੀਆ ਮਿਰਜ਼ਾ ਇੱਕ ਬੈਡਮਿੰਟਨ ਖਿਲਾਰੀ ਹੈ ਇਸ ਨੇ ਵੀ ਆਪਣੀ ਗੇਮ ਰਾਹੀਂ ਦੇ ਦੇਸ਼ ਦੀਆਂ ਬੁਲੰਦੀਆਂ ਤੱਕ ਪਹੁੰਚੀ ਹੈ ਇਸੇ ਤਰ੍ਹਾਂ ਹੀ ਮੈਰੀ ਕੌਮ ਜੋ ਕਿ ਇੱਕ ਬੌਕਸਿੰਗ ਵਿੱਚ ਬੌਕਸਿੰਗ ਵਿੱਚ ਆਪਣਾ ਕੈਰੀਅਰ ਬਣਾਇਆ ਹੈ ਇਸ ਤੋਂ ਬਾਅਦ ਸੌਰਵ ਗਾਂਗੂਲੀ ਇੱਦਾਂ ਦੇ ਖਿਡਾਰੀਆਂ ਨੇ ਆਪਣੀਆਂ ਅਕੈਡਮੀਆਂ ਖੋਲ੍ਹੀਆਂ ਹਨ ਜਿਨ੍ਹਾਂ ਵਿੱਚ ਬੱਚਿਆਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ ਅਤੇ ਉਹ ਕੀ ਹੈ ਨਵੇਂ ਤੋਂ ਨਵੇਂ ਖਿਆ ਖਿਡਾਰੀ ਤਿਆਰ ਕਰਦੇ ਹਨ ਹਾਂ ਵਿਦਿਆਰਥੀਆਂ ਨੇ ਅੱਜ ਕੱਲ੍ਹ ਵਿਦਿਆਰਥੀ ਸਕੂਲਾਂ ਵਿੱਚ ਹਿੱਸਾ ਲੈਂਦੇ ਹਨ ਜਿਵੇਂ ਸਰਕਾਰੀ ਸਕੂਲ ਗੈਰ ਸਰਕਾਰੀ ਸਕੂਲ ਵਿੱਚ ਬੱਚਿਆਂ ਨੂੰ ਵੱਧ ਚੜ੍ਹ ਕੇ ਖੇਡਾਂ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਜਾਂਦਾ ਹੈ ਬੱਚੇ ਵੱਧ ਤੋਂ ਵੱਧ ਹਿੱਸਾ ਲੈਂਦੇ ਹਨ ਜੋ ਕਿ ਸਟੇਟ ਲੈਵਲ ਡਿਸਟ੍ਰਿਕਟ ਲੈਵਲ ਅਤੇ ਇਸ ਤੋਂ ਵੀ ਉੱਪਰ ਲੈਵਲ 'ਤੇ ਜਾਂਦੇ ਹਨ ਜੋ ਕਿ ਆਪਣੇ ਦੇਸ਼ ਆਪਣੇ ਆਪਣੇ ਦੇਸ਼ ਦਾ ਨਾਮ ਰੌਸ਼ਨ ਕਰਦੇ ਹਨ ਅਤੇ ਆਪਣੇ ਪਰਿਵਾਰ ਦਾ ਨਾਮ ਰੌਸ਼ਨ ਕਰਦੇ ਹਨ ਖੇਡਾਂ ਵਿੱਚ ਉਹਨਾਂ ਅੱਜ ਕੱਲ੍ਹ ਬਹੁਤ ਜ਼ਿਆਦਾ ਉੱਨਤੀ ਹੈ ਜੇਕਰ ਬੱਚੇ ਖੇਡਾਂ ਵੱਲ ਧਿਆਨ ਦੇਣ ਤਾਂ ਉਹ ਨਸ਼ਿਆਂ ਵੱਲ ਨਹੀਂ ਜਾਂਦੇ ਅਤੇ ਉਹਨਾਂ ਦਾ ਸਰੀਰ ਵੀ ਬਹੁਤ ਸੋਹਣਾ ਬਣ ਜਾਂਦਾ ਹੈ